ਮੈਂ ਹੱਲੇ ਤਾਂ ਸਿੱਖ ਰਹੀ ਹਾਂ ਮੈਂ ਇੰਨੀ ਪਰਫੈਕਟ ਨਹੀਂ ਕਿ ਮੈਂ ਆਪਣੇ ਆਪ ਦੀ ਤੁਲਨਾ ਕਿਸੇ ਹੋਰ ਲੇਖਕ ਨਾਲ ਕਰਾਂ ਪਰ ਹਾਂ ਇਹ ਜ਼ਰੂਰ ਕਹਿ ਸਕਦੀ ਹਾਂ ਕਿ ਮੈਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਲਈ ਅਤੇ ਆਪਣੀਆਂ ਲਿਖਤ ਨੂੰ ਹੋਰ ਪਰਿਭਾਸ਼ਾ ਲਈ ਬਣਾਉਣ ਲਈ ਆਪਣੀਆਂ ਲਿਖਤਾਂ ਨੂੰ ਦੂਸਰੇ ਲੇਖਕਾਂ ਦੀਆਂ ਰਚਨਾਵਾਂ ਨਾਲ ਜ਼ਰੂਰ ਤੁਲਨਾ ਕਰਕੇ ਵੇਖਦੀ ਹਾਂ ਕਿ ਮੇਰੀ ਕਿੱਥੇ ਕਮੀ ਰਹਿ ਗਈ ਹੈ ਮੈਂ ਇਸ ਨੂੰ ਹੋਰ ਵਧੀਆ ਕਿਵੇਂ ਬਣਾ ਸਕਦੀ ਹਾਂ ਪਰ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਮੈਂ ਕੁਝ ਨਵਾਂ ਅਤੇ ਅਲੱਗ ਲਿਖ ਸਕਾਂ ਜੇ ਆਪਾਂ ਗੱਲ ਸੁਧਾਰ ਦੀ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਕਿਤਾਬਾਂ ਲਿਖਣ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਸ਼ਲੀਲਤਾ ਨਾ ਫੈਲੇ ਕਿਉਂਕਿ ਇਸ ਗੱਲ ਨਾਲ ਸਾਡੇ ਸਮਾਜ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਸਾਨੂੰ ਲਿਖਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਕਿਤਾਬ ਨੂੰ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਹਰੇਕ ਵਿਅਕਤੀ ਪੜ੍ਹ ਸ